ਅਸੀਂ ਘਰ ਵਿੱਚ ਚਾਰ ਭੈਣ ਭਰਾ ਹਾਂ ਜਿਵੇਂ ਕਿ ਮੇਰੇ ਬ੍ਰਦਰ ਅਤੇ ਮੇਰੀ ਸਿਸਟਰ ਦਾ ਸੁਭਾਅ ਅਲੱਗ ਹੈ ਮੇਰਾ ਸੁਭਾਅ ਸਭ ਤੋਂ ਅਲੱਗ ਹੈ ਜਿਵੇਂ ਕਿ ਅਸੀਂ ਸਾਰੇ ਇਕੱਠੇ ਰਹਿੰਦੇ ਹਾਂ ਪਰ ਮੈਂ ਸਾਰਿਆਂ ਤੋਂ ਅ ਅਲੱਗ ਹਾਂ ਮੈਨੂੰ ਆਪਣੇ ਮਾਂ ਬਾਪ ਦੀ ਸੇਵਾ ਕਰਨਾ ਪੜ੍ਹਾਈ ਕਰਨਾ ਜਿਵੇਂ ਕਿ ਪਾਰਲਰ ਦਾ ਸ਼ੌਂਕ ਹੋ ਗਿਆ ਸਿਲਾਈ ਦਾ ਸ਼ੌਂਕ ਹੋ ਗਿਆ ਖਾਣ ਪੀਣ ਦਾ ਸ਼ੌਂਕ ਹੋ ਗਿਆ ਮੇਰੇ ਸ਼ੌਂਕ ਸਾਰਿਆਂ ਤੋਂ ਅਲੱਗ ਹਨ ਅਤੇ ਮੇਰੇ ਸਾਰੇ ਭੈਣ ਭਰਾ ਮੇਰੇ ਤੋਂ ਅਲੱਗ ਹਨ ਅਤੇ ਉਹਨਾਂ ਦੀ ਸ਼ਕਲ ਵੀ ਮੇਰੇ ਤੋਂ ਅਲੱਗ ਹੈ ਅਤੇ ਮੇਰੀ ਸ਼ਕਲ ਅਲੱਗ ਹੈ ਮੈਂ ਆਪਣੇ ਫਾਦਰ ਵਰਗੀ ਹਾਂ ਅਤੇ ਮੇਰਾ ਸੁਭਾਅ ਉਹਨਾਂ ਵਰਗਾ ਹੀ ਹੈ